ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਕਦਰ ਆਪਣੇ ਪਰਿਵਾਰ ਦੀ ਕਰਦੀ ਹਾਂ ਪਰਿਵਾਰ ਸਾਡੀ ਤਾਕਤ ਅਤੇ ਅੰਦਰੂਨੀ ਊਰਜਾ ਦਾ ਕੇਂਦਰ ਹੈ ਇਸ ਦੇ ਬਲਵੁਤੇ ਅਸੀਂ ਸਮਾਜਿਕ ਜੀਵਨ ਦਾ ਸਰਵ ਉੱਚ ਹਾਸਿਲ ਕਰ ਸਕਦੇ ਹਾਂ ਇਹ ਸੰਸਕ੍ਰਿਤੀ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਦੀ ਮੁੱਢਲੀ ਪਾਠਸ਼ਾਲਾ ਵੀ ਹੈ ਪਰਿਵਾਰ ਨਾਲ਼ ਹੀ ਸਾਡੇ ਅੰਦਰ ਸਦਗੁਣਾਂ ਦਾ ਵਿਕਾਸ ਹੁੰਦਾ ਹੈ ਕਿਸੇ ਵੀ ਵਿਅਕਤੀ ਦੇ ਵਿਕਾਸ 'ਚ ਉਸਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਬੱਚੇ 'ਤੇ ਪਹਿਲਾ ਅਸਰ ਪਰਿਵਾਰ ਦੇ ਮਾਹੌਲ ਦਾ ਹੀ ਪੈਂਦਾ ਹੈ ਜੇ ਪਰਿਵਾਰਕ ਮਾਹੌਲ ਚੰਗਾ ਹੈ ਤਾਂ ਉਹ ਤੇਜ਼ੀ ਨਾਲ਼ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਲੱਗਦਾ ਹੈ ਉਸਦੀ ਬੌਧਿਕ ਅਤੇ ਰੂਹਾਨੀ ਸਮਰੱਥਾ ਵਿੱਚ ਵੀ ਹਾਂ ਪੱਖੀ ਤਬਦੀਲੀ ਦੇਖੀ ਜਾ ਸਕਦੀ ਹੈ ਇਸ ਦੇ ਉਲਟ ਜੇ ਪਰਿਵਾਰ ਦਾ ਮਾਹੌਲ ਠੀਕ ਨਾ ਹੋਵੇ ਤਾਂ ਬੱਚਾ ਟੁੱਟਣ ਲੱਗਦਾ ਹੈ ਉਸਦੇ ਵਿਕਾਸ 'ਚ ਰੁਕਾਵਟ ਪੈਣ ਲੱਗਦੀ ਹੈ ਉਹ ਮਾਨਸਿਕ ਅਤੇ ਬੌਧਿਕ ਤੌਰ 'ਤੇ ਕਮਜ਼ੋਰ ਹੋਣ ਲੱਗਦਾ ਹੈ ਉਸ ਦੇ ਸੁਭਾਅ 'ਚ ਨਾ ਪੱਖੀ ਸੋਚ ਘਰ ਕਰਨ ਲੱਗ ਜਾਂਦੀ ਹੈ ਉਹ ਚਿੜਚਿੜਾ ਹੋ ਜਾਂਦਾ ਹੈ ਕਦੇ ਕਦੇ ਉਹ ਹਿੰਸਕ ਵੀ ਹੋ ਜਾਂਦਾ ਹੈ ਪਿਆਰ ਮੁਹੱਬਤ ਮਮਤਾ ਤਿਆਗ ਭਰੋਸਾ ਇਹ ਸਾਰੇ ਪਰਿਵਾਰ ਦੇ ਮਹੱਤਵਪੂਰਨ ਗੁਣ ਹਨ